ਖਬਰਾਂ ਤਾਂ ਮੈਂ ਰੋਜ਼ ਸੁਣਦੀ ਹਾਂ ਬੜੀਆਂ ਵਧੀਆ ਖਬਰਾਂ ਆਉਂਦੀਆਂ ਅੱਜ ਸਵੇਰੇ ਖਬਰਾਂ ਸੁਣ ਰਹੀ ਹਾਂ ਟੀ ਵੀ 'ਤੇ ਦੇਖ ਰਹੇ ਹਾਂ ਚਾ ਛੋਟੇ ਸਾਹਿਬਜ਼ਾਦਿਆਂ ਬਾਰੇ ਕਿ ਜਿਹਨਾਂ ਨੂੰ ਜਿਉਂਦੇ ਹੀ ਨੀਹਾਂ ਵਿੱਚ ਚਿਣ ਦਿੱਤਾ ਗਿਆ ਸੀ ਉਨ੍ਹਾਂ ਬੱਚਿਆ ਨੇ ਆਪਣੀ ਜਾਨ ਦੇ ਦਿੱਤੀ ਪਰ ਧਰਮ ਨਹੀਂ ਹਾਰਿਆ ਅਤੇ ਅੱਜ ਸਰਕਾਰ ਨੇ ਬਾਲ ਦਿਵਸ ਮਨਾਉਣ ਦਾ ਐਲਾਨ ਕੀਤਾ ਅਤੇ ਅੱਜ ਸਵੇਰੇ ਸਵੇਰੇ ਖਬਰ ਆਈ ਕਿ ਫਤਿਹਗੜ੍ਹ ਸਾਹਿਬ ਵਿੱਚ ਮਿਊਜ਼ੀਅਮ ਬਣੇਗਾ ਅਤੇ ਜੋ ਕਿ ਬਹੁਤ ਵਧੀਆ ਕੰਮ ਸਰਕਾਰ ਕਰ ਰਹੀ ਹੈ ਅਤੇ ਮੈਂ ਵੀ ਜਾਵਾਂਗੀ ਆਪਣੇ ਬੱਚੇ ਨੂੰ ਦਿਖਾ ਕੇ ਲਿਆਵਾਂਗੀ ਕਿ ਬੱਚਿਆਂ ਦੀ ਯਾਦ ਵਿੱਚ ਇਹ ਚੀਜ਼ਾਂ ਬਣਾਈ ਜਾਂਦੀਆਂ ਅਤੇ ਮੈਂ ਸਰਕਾਰ ਦਾ ਬਹੁਤ ਅਤਿ ਧੰਨਵਾਦੀ ਹੋਵਾਂਗੀ